ਮੇਰਾ ਨਾ ਅਭਿਸ਼ੇਕ ਹੈ ਜੀ ਕੀ ਤੁਸੀਂ ਸਿਲਵਰ ਔਕ ਦੇ ਮੈਨੇਜਰ ਬੋਲ ਰਹੇ ਹੋ ਜੀ ਮੇਰਾ ਨਾ ਵੀਹ ਤਰੀਕ ਨੂੰ ਜਨਮਦਿਨ ਹੈ ਜੀ ਜਿਸ ਦਿਨ ਮੈਨੂੰ ਸ਼ਾਹੀ ਪਨੀਰ ਮਟਰ ਪਨੀਰ ਕੜਾਹੀ ਪਨੀਰ ਰੋਟੀਆਂ ਆਈਸਕ੍ਰੀਮ ਪਾਣੀ ਇਹ ਸਭ ਕੁਛ ਚਾਹੀਦਾ ਏ ਜੀ ਖਾਣਾ ਓਇਲੀ ਨਾ ਹੋਵੇ ਜੀ ਜ਼ਿਆਦਾ ਵਧੀਆ ਖਾਣਾ ਫਰੈਸ਼ ਹੋਵੇ ਜੀ ਕਿਉਂਕਿ ਮੇਰੇ ਯਾਰ ਦੋਸਤਾਂ ਨੇ ਆਉਣਾ ਰਿਸ਼ਤੇਦਾਰਾਂ ਨੇ ਆਉਣਾ ਉਸ ਸਾਹਮਣੇ ਮੇਰੀ ਬੇਇਜ਼ਤੀ ਨਾ ਹੋਵੇ ਜੀ ਖਾਣਾ ਵਧੀਆ ਹੋਣਾ ਚਾਹੀਦਾ ਤੁਹਾਡਾ ਰੈਪੂਟੇਡਿਡ ਨਾਂ ਹੈ ਜੀ ਤਾਂ ਮੈਂ ਤੁਹਾਨੂੰ ਫੋਨ ਕਰਿਆ ਜੀ ਇਹ ਵਧੀਆ ਹੋਣਾ ਚਾਹੀਦਾ ਖਾਣਾ ਕਿਉਂਕਿ ਜੀ ਇਹਨੇ ਰਿਸ਼ਤੇਦਾਰ ਨੇ ਜਾਂ ਕੁਛ ਹੋਰ ਕੋਈ ਪੁਰਾਣਾ ਨਾ ਹੋਵੇ ਖਾਣਾ ਫਰੈਸ਼ ਹੋਣਾ ਚਾਹੀਦਾ ਜੀ ਵਧੀਆ ਸਵਾਦ ਹ ਹੋਣਾ ਚਾਹੀਦਾ ਹੈ ਆਈਸਕ੍ਰੀਮ ਉਸਕ੍ਰੀਮ ਵੀ ਪਾ ਦਿਓ ਅਤੇ ਮੈਂ ਤੁਹਾਡਾ ਰੈਗੂਲਰ ਕੀ ਆਪਣਾ ਬਿੱਲ ਜੋ ਵੀ ਹੈ ਜੀ ਆਪਣਾ ਵੀਹ ਤਰੀਕ ਨੂੰ ਪੁਜਾ ਦਿਓ ਟਾਈਮ ਸਵੇਰੇ ਅੱਠ ਵਜੇ ਤੱਕ ਅਤੇ ਕੀ ਆਪਣਾ ਪ੍ਰਾਈਸ 'ਚ ਕੀ ਹੋਣਾ ਜੀ ਉਸ ਦਿਨ ਕਿਆ ਡਿਸਕਾਊਂਟ ਚੱਲ ਰਿਹਾ ਜੀ ਮੇਰੇ ਲਈ ਤੁਹਾਡਾ ਮੈਂ ਰੈਗੂਲਰ ਕੰਮ ਰ ਰੈਗੂਲਰ ਗ੍ਰਾਹਕ ਹੈ ਮੈਂ ਤੁਹਾਡਾ ਹਾਂਜੀ ਵੀਹ ਤਰੀਕ ਨੂੰ ਵੀਹ ਤਰੀਕ ਨੂੰ ਚਾਹੀਦਾ ਜੀ ਹੁਣ ਤੁਸੀਂ ਆਪ ਦੇਖ ਲਉ ਇਹ ਨਾਂ ਟਾਈਮ ਸਿਰ ਕਰ ਦਿਓ ਬਾਕੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੈ ਜੀ ਠੀਕ ਹੈ ਜੀ